ਨਵੇਂ ਜਨਮੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਨਵੇਂ ਜਨਮੇ ਬੱਚਿਆਂ ਦੇ ਆਲੇ ਦੁਆਲੇ ਵਾਤਾਵਰਨ ਬਹੁਤ ਹੀ ਸਵੱਛ ਹੋਣਾ ਚਾਹੀਦਾ ਹੈ ਨਵੇਂ ਜਨਮੇ ਬੱਚਿਆਂ ਨੂੰ ਸਵੇਰ ਦੀ ਧੁੱਪ ਲਵਾਉਣੀ ਚਾਹੀਦੀ ਹੈ ਜਿਸ ਨਾਲ ਉਹਦੇ ਸ਼ਰੀਰ ਵਿੱਚ ਜ਼ਰੂਰੀ ਤੱਤਵ ਪੂਰੇ ਹੁੰਦੇ ਨੇ ਨਵੇਂ ਜਨਮੇ ਬੱਚਿਆਂ ਦੇ ਕੱਪੜੇ ਅਤੇ ਉਨ੍ਹਾਂ ਦੇ ਸਮਾਨ ਸਾਰਾ ਸਾਫ਼ ਸੁਥਰਾ ਡਿਟੋਲ ਨਾਲ ਧੋਣਾ ਚਾਹੀਦਾ ਹੈ ਉਨ੍ਹਾਂ ਦੇ ਵਰਤੋਂ ਕੀਤੇ ਗਏ ਭਾਂਡੇ ਜਿਵੇਂ ਚਮਚ ਕੱਚ ਦੀ ਬੋਟਲ ਨਿੱਪਲ ਐਹ ਸਾਰਿਆਂ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਬੋਆਇਲ ਕਰਕੇ ਫਿਰ ਵਰਤਣੀ ਚਾਹੀਦੀ ਹੈ ਨਵੇਂ ਜਨਮੇ ਬੱਚਿਆਂ ਦੇ ਕੋਲ ਕੋਈ ਵੀ ਬਿਮਾਰ ਵਿਅਕਤੀ ਜਿਹਨੂੰ ਖੰਘ ਖਾਂਸੀ ਜੁਖਾਮ ਹੋਵੇ ਭਾਵੇਂ ਉਹਦੀ ਆਪਣੀ ਮਾਂ ਕਿਉਂ ਨਾ ਹੋਵੇ ਉਹ ਨੇੜੇ ਨਹੀਂ ਆਉਣੇ ਚਾਹੀਦੇ ਨੇ ਨਵੇਂ ਜਨਮੇ ਬੱਚਿਆਂ ਨੂੰ ਮਾਤਾ ਦਾ ਦੁੱਧ ਪਿਆਣਾ ਚਾਹੀਦਾ ਹੈ ਜੇ ਉਹ ਜਿਹਦੇ ਅੰਦਰ ਸਾਰੇ ਪੋਸ਼ਟਿਕ ਤੱਤਵ ਹੁੰਦੇ ਨੇ ਜਿਹਦੇ ਨਾਲ ਨਵੇਂ ਜਨਮੇ ਬੱਚੇ ਦਾ ਵਿਕਾਸ ਵਧੀਆ ਹੁੰਦਾ ਹੈ ਨਵੇਂ ਜਨਮੇ ਬੱਚਿਆਂ ਨੂੰ ਕਿਸੀ ਵੀ ਗੈਰ ਬੰਦੇ ਕੋਲ ਨਹੀਂ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਸੀਂ ਅਣਪਛਾਤਾ ਹੋਵੇ ਜਿਸ ਨੂੰ ਬਾਹਰੋਂ ਆਇਆ ਇਨਫੈਕਸ਼ਨ ਹੋਵੇ ਉਹਦੇ ਕੋਲ ਨਹੀਂ ਰੱਖਣਾ ਚਾਹੀਦਾ ਹੈ ਨਵੇਂ ਜਨਮੇ ਬੱਚਿਆਂ ਦੀ ਦੇਖਭਾਲ ਬਹੁਤ ਹੀ ਸਵੱਛ ਤਰੀਕੇ ਨਾਲ ਹੋਣੀ ਚਾਹੀਦੀ ਹੈ